ਹਾਂ ਮੈਨੂੰ ਹਾਈਕ ਕਰਨ ਵਾਸਤੇ ਜਿਹੜਾ ਅਮਰਨਾਥ ਦਾ ਏਰੀਆ ਨਾ ਉਹ ਬਹੁਤ ਪਸੰਦ ਹੈ ਉੱਥੇ ਪਹਾੜ ਵੀ ਹੈ ਮਤਲਬ ਚੜ੍ਹਾਈ ਟਰੈਕ ਵੀ ਹੋ ਜਾਂਦੀ ਹੈ ਅਤੇ ਨਾਲੇ ਭੋਲੇ ਸ਼ੰਕਰ ਦੇ ਦਰਸ਼ਨ ਵੀ ਹੋ ਜਾਂਦੇ ਹੈ